ਹੈਲੋ ਓਲਾ ਤੋਂ ਬੋਲਦੇ ਅਸੀਂ ਨਾ ਤੁਹਾਡੀ ਕਾਰ ਬੁੱਕ ਕਰਵਾਈ ਸੀ ਪਹਿਲਾਂ ਵੀ ਇੱਕ ਵਾਰ ਅਤੇ ਬੜਾ ਵਧੀਆ ਸਫ਼ਰ ਸੀ ਉਹਦਾ ਅਤੇ ਹੁਣ ਅਸੀਂ ਫਿਰ ਆਪਣੇ ਪਿੰਡ ਤੋਂ ਅਸੀਂ ਚੰਡੀਗੜ੍ਹ ਜਾਣਾ ਵਾਂ ਅਤੇ ਅਸੀਂ ਉੱਥੇ ਘੁੰਮਣਾ ਹਾਂ ਰੋਜ਼ ਗਾਰਡਨ ਵਗੈਰਾ ਅਤੇ ਦ ਸੁਖਨਾ ਝੀਲ ਜਾਣਾ ਆਪਾਂ ਬੱਚਿਆਂ ਨੂੰ ਲੈ ਨਾਲ ਲੈ ਕੇ ਸਾਡੇ ਪਰਿਵਾਰ ਸਾਡੀ ਫੈਮਿਲੀ ਨਾਲ ਵਾ ਜਦੋਂ ਆਪਾਂ ਤੁਹਾਡੀ ਪਹਿਲਾਂ ਕੈਬ ਬੁੱਕ ਕਰਵਾਈ ਸੀ ਅਤੇ ਉਦੋਂ ਵੀ ਸਾਡੀ ਫੈਮਿਲੀ ਨਾਲ ਸੀ ਅਤੇ ਅਸੀਂ ਬੜਾ ਇੰਜੋਏ ਕੀਤਾ ਸੀ ਤੁਹਾਡੀ ਕੈਬਸ ਸਾਨੂੰ ਬਹੁਤ ਵਧੀਆ ਲੱਗੀ ਅਤੇ ਗੱਡੀ ਜਿਹੜੀ ਆਪਾਂ ਤੁਹਾਡੀ ਲੈ ਕੇ ਗਏ ਸੀ ਤੁਹਾਡਾ ਡਰਾਈਵਰ ਵੀ ਬਹੁਤ ਵਧੀਆ ਸੀ ਜਿਹੜਾ ਸਾਨੂੰ ਵੀ ਵਧੀਆ ਉਹਨੇ ਟਰੀਟ ਕੀਤਾ ਅਤੇ ਉਹਦਾ ਵੀ ਬਿਲਕੁਲ ਸਾਰਾ ਕੁਛ ਬਹੁਤ ਵਧੀਆ ਸੀ ਗੱਡੀ ਬਹੁਤ ਵਧੀਆ ਸੀ ਤੁਹਾਡੀ ਉਹ ਉਹਦੇ ਵਿੱਚ ਬਹਿਣ 'ਚ ਵੀ ਬਹੁਤ ਮਜ਼ਾ ਕੰਫੇਟੇਬਲ ਸੀ ਗੱਡੀ ਉਹ ਅਤੇ ਆਪਾਂ ਇਹ ਚਾਹੁੰਦੇ ਹਾਂ ਕਿ ਅਸੀਂ ਹੁਣ ਆਪਣੇ ਸਥਾਨ 'ਤੇ ਪਹੁੰਚ ਗਏ ਹਾਂ ਉੱਥੇ ਜਿੱਥੇ ਅਸੀਂ ਜਾਣਾ ਸੀ ਚੰਡੀਗੜ੍ਹ ਅਤੇ ਹੁਣ ਅਸੀਂ ਅਸੀਂ ਦੂਜੀ ਵਾਰ ਬੁੱਕ ਕੀਤੀ ਹੈ ਅਤੇ ਅਸੀਂ ਪਹੁੰਚ ਗਏ ਹਾਂ ਪਰ ਸਾਨੂੰ ਇਹ ਚਾਹੀਦਾ ਵਾ ਕਿ ਸਾਡੇ ਕੋਲ ਕੈਸ਼ ਨਹੀਂ ਸੀ ਹੈਗੇ ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਕੋਈ ਗੂਗਲ ਪੇ ਕਰ ਦਈਏ ਜਾਂ ਪੇਟੀਐੱਮ ਕਰ ਦਈਏ ਤੁਸੀਂ ਮੈਨੂੰ ਇਹ ਦੱਸ ਦਿਉ ਕਿ ਮੈਂ ਕਰ ਸਕਦੀ ਹਾਂ ਅਤੇ ਪਹਿਲਾਂ ਵੀ ਵਧੀਆ ਤੁਸੀਂ ਸਫਰ ਪਹਿਲਾਂ ਵੀ ਅਸੀਂ ਔਨਲਾਈਨ ਪੇਮੈਂਟ ਕੀਤੀ ਸੀ ਉਦੋਂ ਵੀ ਅਤੇ ਮੈਂ ਹੁਣ ਚਾਹੁੰਦੀ ਹਾਂ ਕਿ ਅਸੀਂ ਫਿਰ ਇੱਕ ਵਾਰੀ ਕਰ ਦਿੰਦੇ ਔਨਲਾਈਨ ਪੇਮੈਂਟ ਜਾਂ ਜੇ ਤੁਸੀਂ ਕਹਿੰਦੇ ਜੇ ਤਾਂ ਅਤੇ ਸਾਡੇ ਬੱਚੇ ਵੀ ਬੜੇ ਖੁਸ਼ ਸੀ ਅਸੀਂ ਇੱਦਾਂ ਇਹ ਕੈਬ ਵਿੱਚ ਗਏ ਹਾਂ ਸਾਰੇ ਬੜਾ ਵਧੀਆ ਵੀ ਵਧੀਆ ਸਾਡਾ ਫ੍ਰੀ ਟਾਈਮ ਲੰਘ ਲਿਆ ਨਿਕਲਿਆ ਵਾ ਅਤੇ ਚਲੋ ਠੀਕ ਹੈ ਫਿਰ ਅਸੀਂ ਜੇ ਤੁਸੀਂ ਕਹਿੰਦੇ ਜੇ ਤਾਂ ਅਸੀਂ ਔਨਲਾਈਨ ਪੇਮੈਂਟ ਕਰ ਦਿੰਦੇ ਹਾਂ ਉਹਨਾਂ ਨੂੰ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ